ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਤੁਸੀਂ ਦੱਸੋ ਹਾਂਜੀ ਅੱਛਾ ਹਾਂਜੀ ਸਾਡੇ ਇੱਥੇ ਮਤਲਬ ਕਿ ਜੋ ਬਸ ਸਟੈਂਡ ਹੈਗਾ ਉਹਦੀ ਬੈਕ ਸਾਈਡ ਔਰਗੈਨਿਕ ਖੈਤੀ ਖੇਤੀ ਵਗੈਰਾ ਕਰਦੇ ਹੈਗੇ ਆ ਜੀ ਉੱਥੇ ਵਧੀਆ ਸਬਜ਼ੀ ਮਿਲ ਜਾਊਗੀ ਮੌਸ ਮੌਸਮ ਦੇ ਅਨੁਸਾਰ ਜੋ ਵੀ ਤੁਹਾਨੂੰ ਚਾਹੀਦੀ ਹੋਈ ਅਤੇ ਇੱਕ ਇੱਧਰ ਮੈਂ ਰੇਲਵੇ ਸਟੇਸ਼ਨ ਦੇ ਕੋਲ ਵੀ ਉੱਥੇ ਵੀ ਮਤਲਬ ਕਿ ਖਾਦ ਖਾਦ ਵਗੈਰਾ ਵਧੀਆ ਵਰਤਦੇ ਹੈ ਜੀ ਵੈਸੇ ਸਬਜ਼ੀ ਮਹੈ ਮਹਿੰਗੀ ਲੱਗ ਜੂਗੀ ਪਰ ਵਧੀਆ ਕੁਆਲਿਟੀ ਦੀ ਮਿਲੂਗੀ ਜੀ

ਜੀ ਹੋਰ ਕੋਈ ਪ੍ਰੋਬਲਮ ਹੋਵੇ ਤਾਂ ਉਹ ਵੀ ਪੁੱਛ ਸਕਦੇ ਹੋ ਜੀ ਹਾਂਜੀ ਉਹ ਤਾਂ ਸਹੀ ਗੱਲ ਹੈ ਜੀ ਦੇਖੋ ਕੋਈ ਗੱਲ ਨਹੀਂ ਤੁਸੀਂ ਮਤਲਬ ਕਿ ਸਬਜ਼ੀ ਲੈਣੀ ਹੋਵੇ ਤਾਂ ਇੱਥੋਂ ਤੁਸੀਂ ਖਰੀਦ ਸਕਦੇ ਹੋ ਠੀਕ ਹੈ ਜੀ